ਸਤਿ ਸ਼੍ਰੀ ਅਕਾਲ ਮੈਂ ਪ੍ਰਿਆ ਜੇਕਰ ਪੰਜਾਬ ਦੇ ਬਜ਼ਾਰਾਂ ਬਾਰੇ ਗੱਲ ਕੀਤੀ ਜਾਏ ਤਾਂ ਮੈਂ ਇੰਨਾਂ ਤਾਂ ਨਹੀਂ ਜਾਣਦੀ ਇੰਨਾਂ ਘੁੰਮੀ ਫਿਰੀ ਨਹੀਂ ਹਾਂ ਬਟ ਮੈਂ ਆਪਣੇ ਲੋਕਲ ਬਜ਼ਾਰ ਦੀ ਗੱਲ ਕਰ ਸਕਦੀ ਹਾਂ ਇੱਥੇ ਲੋਕਲ ਬਜ਼ਾਰ ਮੈਨੂੰ ਪੈਂਦਾ ਹੈਗਾ ਪਠਾਨਕੋਟ ਅਤੇ ਇੱਥੇ ਹਰ ਤਰ੍ਹਾਂ ਦਾ ਜਿਹੜੀ ਸਮਾਨ ਹੈਗਾ ਸਾਨੂੰ ਮਿਲ ਜਾਂਦਾ ਹੈ ਇਸ ਕਰਕੇ ਸਾਨੂੰ ਕਿਸੇ ਹੋਰ ਬਜ਼ਾਰ ਜਾਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇੱਥੇ ਕੱਪੜੇ ਤੋਂ ਲੈ ਕੇ ਹਾਊਸ ਹੋਲਡਿੰਗ ਦਾ ਹਰ ਸਮਾਨ ਮਿਲ ਜਾਂਦਾ ਹੈ ਔਰ ਹਰ ਬਰੈਂਡ ਦਾ ਜਿਹੜਾ ਦੁਨੀਆਂ ਭਰ ਦਾ ਸਮਾਨ ਹੈਗਾ ਉਹ ਇੱਥੋਂ ਸਾਨੂੰ ਮਿਲ ਜਾਂਦਾ ਹੈ ਜੇਕਰ ਕੱਪੜੇ ਦੀ ਗੱਲ ਕਰੀਏ ਅਤੇ ਇੱਥੇ ਦੂਸਰੀ ਸੀਟੀਜ ਤੋਂ ਵੀ ਲੋਕ ਆਉਂਦੇ ਹਨ ਜਿਵੇਂ ਕਿ ਧਰਮਸ਼ਾਲਾ ਸ਼ਿਮਲਾ ਹੋਰ ਵੀ ਨੇੜੇ ਤੇੜੇ ਲੁਧਿਆਣਾ ਜਲੰਧਰ ਇੱਥੋਂ ਲੋਕ ਪਠਾਨਕੋਟ ਸ਼ੋਪਿੰਗ ਕਰਨ ਆਉਂਦੇ ਹਨ ਕਿਉਂਕਿ ਇੱਥੋਂ ਦਾ ਜਿਹੜਾ ਕੱਪੜਾ ਹੈ ਉਹ ਵਧੀਆ ਕੁਆਲਿਟੀ ਦਾ ਹੈ ਅਤੇ ਇੱਥੇ ਇਸ ਕੱਪੜਾ ਵੀ ਜਿਹੜਾ ਹੈ ਉਹ ਸਸਤਾ ਮਿਲਦਾ ਹੈ ਅਤੇ ਅੱਜ ਦੇ ਜ਼ਮਾਨੇ ਦਾ ਮਿਲਦਾ ਹੈ ਅਤੇ ਹੋਰ ਵੀ ਇੱਥੇ ਹਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਸ਼ੋਅਰੂਮ ਖੁੱਲ੍ਹ ਗਏ ਹਨ ਜਿਸਦੇ ਵਿੱਚ ਵੈਸਟਰਨ ਡਰੈਸਿਜ਼ ਜਿਹੜੀਆਂ ਹੈ ਉਹ ਮਿਲ ਜਾਂਦੀਆਂ ਹਨ ਉਹ ਧੰਨਵਾਦ ਜੀ